ਮਾਰਸ਼ਲ ਆਰਟ ਇੱਕ ਅਜਿਹੀ ਖੇਡ ਹੈ ਜਿਸ ਨੂੰ ਹਰ ਇੱਕ ਵਿਅਕਤੀ ਖੇਡ ਸਕਦਾ ਹੈ ਅਤੇ ਇਸ ਵਿੱਚ ਬਹੁਤ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਮੈਂ ਇੱਕ ਖਿਡਾਰੀ ਹਾਂ ਮੈਂ ਸ਼ੁਰੂ ਤੋਂ ਹੀ ਮਾਰਸ਼ਲ ਆਰਟ ਦਾ ਪਲੇਅਰ ਰਿਹਾ ਹਾਂ ਮੈਨੂੰ ਬਹੁਤ ਸ਼ੌਕ ਸੀ ਮਾਰਸ਼ਲ ਆਰਟ ਸਿੱਖਣ ਦਾ ਅਤੇ ਮੈਂ ਉਸ ਨੂੰ ਸਿੱਖਣ ਲਈ ਮਾਨਸਾ ਜਾਂਦਾ ਸੀ ਜਿਸ ਤੋਂ ਮਾਨਸਾ ਜਾਂਦਾ ਸੀ ਤਾਂ ਬੱਸਾਂ ਵਿੱਚ ਬਹੁਤ ਧੱਕੇ ਖਾਣੇ ਪੈਂਦੇ ਸੀ ਬਹੁਤ ਸਾਹਮਣਾ ਕਰਨਾ ਪੈਂਦਾ ਸੀ ਸਵਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਸੀ ਅਤੇ ਉਹਨਾਂ ਵਿੱਚ ਖੜ੍ਹ ਕੇ ਜਾਣਾ ਅਤੇ ਉਸ ਤੋਂ ਬਾਅਦ ਕਰਾਇਆ ਨਾ ਹੋਣ ਦੇ ਬਾਵਜੂਦ ਵੀ ਅਸੀਂ ਬੱਸ ਵਿੱਚ ਬੈਠ ਕੇ ਜਾਣਾ ਉਸ ਤੋਂ ਬਾਅਦ ਗਰਾਉਂਡ ਵਿੱਚ ਗਰਾਊਂਡ ਸਾਡਾ ਲਗਭਗ ਉੱਥੋਂ ਢਾਈ ਕਿਲੋਮੀਟਰ ਹੁੰਦਾ ਸੀ ਬੱਸ ਸਟੈਂਡ ਤੋਂ ਤਾਂ ਅਸੀਂ ਬਿਨਾਂ ਰਿਕਸ਼ਾ ਕਰਾਏ ਬੱਸ ਸਟੈਂਡ ਤੱਕ ਬੱਸ ਸਟੈਂਡ ਤੋਂ ਗਰਾਉਂਡ ਤੱਕ ਭੱਜ ਕੇ ਜਾਂਦੇ ਤਾਂ ਜੋ ਨਾਲੇ ਤਾਂ ਅਸੀਂ ਵਾਰਮ ਅਪ ਹੋ ਜਾਂਦੇ ਅਤੇ ਨਾਲ ਨਾਲ ਹੀ ਸਾਡਾ ਕਿਰਾਇਆ ਵੀ ਬਚ ਜਾਂਦਾ ਸੀ ਤਾਂ ਜੋ ਇਹੋ ਜਿਹੀਆਂ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਖਿਡਾਰੀ ਬਹੁਤ ਖਠਨੈ ਕਠਿਨਾਈਆਂ ਦਾ ਸਾਹਮਣਾ ਕਰਕੇ ਖਿਡਾਰੀ ਬਣਦਾ ਹੈ ਅਤੇ ਅਸੀਂ ਖੇਡਾਂ ਨੂੰ ਖੇਡਣ ਵੇਲੇ ਮਾਰਸ਼ਲ ਆਰਟ ਖੇਡਣ ਵੇਲੇ ਸੱਟਾਂ ਬਹੁਤ ਜ਼ਿਆਦਾ ਲੱਗਦੀਆਂ ਹਨ ਅਤੇ ਸਰੀਰ ਵਿੱਚ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਥਕਾਵਟ ਨੂੰ ਦੂਰ ਕਰਨ ਲਈ ਅਸੀਂ ਹਰ ਰੋਜ਼ ਵੱਧ ਤੋਂ ਵੱਧ ਪਾਣੀ ਵੱਧ ਤੋਂ ਵੱਧ ਗੁਲੂਕੋਜ਼ ਵੱਧ ਤੋਂ ਵੱਧ ਪ੍ਰੋਟੀਨ ਖਾਂਦੇ ਹਾਂ ਜਿਸ ਨਾਲ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਅਤੇ ਸਰੀਰ ਨੂੰ ਵਧੀਆ ਇੱਕ ਬਣਾ ਸਕੀਏ ਅਤੇ ਖੇਡਣ ਵੇਲੇ ਸਾਨੂੰ ਕੋਈ ਵੀ ਕਿਸੇ ਗੱਲ ਵਿੱਚ ਰੁਕਾਵਟ ਨਾ ਆਵੇ ਤਾਂ ਜੋ ਅਸੀਂ ਵਧੀਆ ਇੱਕ ਤਕੜੇ ਪਲੇਅਰ ਬਣ ਕੇ ਖੇਡੀਏ ਅਤੇ ਆਪਣੇ ਸਟੇਟ ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਦੂਸਰੇ ਦੇਸ਼ਾਂ ਵਿੱਚ ਰੌਸ਼ਨ ਕਰੀਏ ਆਓ ਅਸੀਂ ਅੱਜ ਰਲ ਕੇ ਇੱਕ ਖੇਡ ਦਾ ਮਾਰਸ਼ਲ ਆਰਟ ਦਾ ਪਰਿਆਸ ਕਰਦੇ ਹਾਂ ਨਾਲ ਅਸੀਂ ਹੋਰ ਬੱਚਿਆਂ ਨੂੰ ਵੀ ਜੋੜਾਂਗੇ ਤਾਂ ਜੋ ਬੱਚਿਆਂ ਦਾ ਭਵਿੱਖ ਸੁਧਰ ਸਕੇ ਅਤੇ ਉਹਨਾਂ ਨੂੰ ਕਿਸੇ ਵੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਅਸੀਂ ਉਹਨਾਂ ਨੂੰ ਇੱਕ ਨਸ਼ੇ ਤੋਂ ਦੂਰ ਰੱਖ ਸਕੀਏ ਅਤੇ ਖੇਡਾਂ ਵੱਲ ਵਧਾ ਸਕੀਏ ਅਤੇ ਉਹਨਾਂ ਦਾ ਆਉਣ ਵਾਲਾ ਜੀਵਨ ਅਤੇ ਉਹਨਾਂ ਦਾ ਸਰੀਰ ਨੂੰ ਤੰਦਰੁਸਤ ਬਣਾਈਏ ਤਾਂ ਜੋ ਉਹ ਬੱਚੇ ਅੱਗੇ ਵਧਣ ਫੁੱਲਣ ਬਹੁਤ ਹੀ ਜ਼ਿਆਦਾ ਵਧੀਆ ਹੋਵੇ